ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਕੀ ਹਾਲ ਹੈ ਜੀ ਕਿਵੇਂ ਹੋ ਹਾਂਜੀ ਹੋਰ ਹਾਂਜੀ ਵਧੀਆ ਅਸੀਂ ਪਟਿਆਲਾ ਸ਼ਹਿਰ ਤੋਂ ਬੋਲਦੇ ਹਾਂ ਜੀ ਹਾਂਜੀ ਮੈਮ ਅਤੇ ਹੋਰ ਦੱਸੋ ਜੀ ਕੀ ਹਾਲ ਆ ਬੱਚੇ ਕਿਵੇਂ ਆ ਹੋਰ ਕੀ ਕਰਦੇ ਸੀਗੇ ਹਾਂਜੀ ਮੈਂ ਜੀ ਆਪ ਦੀ ਫਰੈਂਡ ਤੋਂ ਨੰਬਰ ਲਿੱਤਾ ਸੀ ਤੁਹਾਡਾ ਤੁਸੀਂ ਰਜਨਦੀਪ ਕੌਰ ਬੋਲਦੇ ਹੋ ਹਾਂਜੀ ਅਤੇ ਮੈਂ ਮੈਮ ਉਹਦੇ ਬਾਰੇ ਪੁੱਛਣਾ ਸੀਗਾ ਆਪਣਾ ਵੀ ਇੱਧਰ ਸਾਡੇ ਨਾ ਅਸੀਂ ਇੱਕ ਫੰਕਸ਼ਨ ਅਟੈਂਡ ਕਰਨ ਆਉਣਾ ਗਾ ਅਤੇ ਹਾਂਜੀ ਉਹ ਗਿੱਧੇ ਬਾਰੇ ਹੈ ਜੀ ਹਾਂਜੀ ਅਤੇ ਤੁਸੀਂ ਇੱਧਰ ਮੈਮ ਕੀ ਕੁਝ ਪਹਿਨਦੇ ਹੋ ਗਿੱਧੇ ਦੇ ਵਿੱਚ ਕੀ ਉਹ ਚੱਲਦਾ ਗਾ ਉਹਦੇ ਬਾਰੇ ਦੱਸ ਦਓ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਅਸੀਂ ਇੱਥੇ ਭੰਗੜੇ ਦਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਅੱਛਾ ਜੀ ਠੀਕ ਹੈ ਜੀ ਨਹੀਂ ਮੈਂ ਇੱਥੇ ਹੀ ਉਹ ਕਰਨਾ ਜੀ ਹਾਂਜੀ ਇੱਥੇ ਵੀ ਲੈਣਾ ਕਰਨਾ ਗਾ ਅਤੇ ਤੁਸੀਂ ਬਸ ਮੈਨੂੰ ਦਸ ਦਿਓ ਵੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਓ ਓਕੇ ਜੀ ਹਾਂਜੀ ਓਕੇ ਜੀ ਠੀਕ ਹੈ ਜੀ

ਠੀਕ ਹੈ ਜੀ ਓਕੇ ਜੀ ਓਕੇ ਠੀਕ ਹੈ ਜੀ ਹੋਰ ਬਸ ਜੀ ਇਹੀ ਪੁੱਛਣਾ ਸੀ ਜੀ ਤੁਹਾਨੂੰ ਵੀ ਬਸ ਵੀ ਕੀ ਪਹਿਨਦੇ ਆ ਕੀ ਉਹ ਕਰਦੇ ਆ ਬਸ ਇਸ ਬਾਰੇ ਪਤਾ ਕਰਨਾ ਸੀ

ਹਾਂਜੀ ਹਾਂਜੀ ਠੀਕ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਮੈਮ ਓਕੇ ਜੀ ਚਲੋ ਠੀਕ ਹੈ ਜੀ ਬਸ ਜੀ ਬਸ ਜੀ ਹੋਰ ਹਾਂਜੀ ਹਾਂਜੀ ਵਧੀਆ ਠੀਕ ਠਾਕ ਜੀ ਓਕੇ ਜੀ ਠੀਕ ਹੈ ਜੀ ਬਸ ਤੁਹਾਨੂੰ ਮੈਂ ਕੌਲ ਕਰ ਦੂੰਗੀ ਓਕੇ ਜੀ ਠੀਕ ਹੈ ਜੀ ਓਕੇ ਜੀ ਥੈਂਕ ਯੂ ਜੀ